ਹੈਲੋ ਹਾਂਜੀ ਮੈਮ ਅਸੀਂ ਕੰਪਿਊਟਰ ਸੈਂਸ 'ਚ ਡਿਪਾਰਟਮੈਂਟ ਤੋਂ ਬੋਲ ਰਹੇ ਹਾਂ ਅੱਜ ਸਾਡੇ ਇੱਥੇ ਫੰਕਸ਼ ਸਾਡੇ ਅੱਜ ਇੱਥੇ ਫੰਕਸ਼ਨ ਹੈਗਾ ਜੀ ਇਹ ਅੱਜ ਇੱਥੇ ਆਂ ਸਾਡੇ ਵੀਹ ਪੱਚੀ ਸਟੇਟਸ ਆਏ ਹੋਏ ਨੇ ਤੁਹਾਡੇ ਕੋਲ ਤੁਹਾਡੇ ਕੋਲ ਤੁਹਾਡੇ ਕੋਲ ਖਾਣ ਲਈ ਕੀ ਕੀ ਸਮਾਨ ਹੈਗਾ ਜੀ ਹਾਂ ਤੇ ਤੁਸੀਂ ਆ ਗਿਆਰਾਂ ਵਜੇ ਤੱਕ ਔਡਰ ਕਰਾਂ ਔਡਰ ਭੇਜ ਸਕਦੇ ਹੋ ਅਤੇ ਤੁਸੀਂ ਤੇ ਤੁਸੀਂ ਡਰਿੰਕ ਵਿੱਚ ਕੀ ਕੀ ਸਰਵ ਕਰੋਗੇ ਠੀਕ ਹੈ ਅਸਾਂ ਸਾਨੂੰ ਕੁਛ ਸਾਨੂੰ ਅ ਵੀਹ ਸਮੋਸੇ ਕੋਲਡ ਕੌਫੀ ਬੀਸ ਔਰ ਕੁਛ ਡਰਿੰਕਸ ਭੇਜ ਦੀਜੀਏ ਸਨੈਕਸ ਵੀ ਤੁਸੀਂ ਫ਼੍ਰੇਂਚ ਫਰਾਈਸ ਕਰ ਦਿਓ ਨੂਡਲਸ ਔਰ ਇਹ ਤੁਸੀਂ ਸਾਰਾ ਸਮਾਨ ਔਡਰ ਕਿੰਨੇ ਟਾਈਮ ਤੱਕ ਕਰ ਦਿਓਗੇ

ਤੁਸੀਂ ਅਂ ਡਿਲੀਵਰੀ ਕਰ ਸਕਦੇ ਹੋ ਡਿਲੀਵਰੀ ਕਰ ਦਿਓ ਅਤੇ ਤੁਸੀਂ ਹਾਂਜੀ ਇਹ ਹਾਂਜੀ ਅਸੀਂ ਤੁਹਾਨੂੰ ਅਂ ਈਮੇਲ ਕਰ ਦਿੰਦੇ ਹਾਂ ਅਸੀਂ ਅ ਹਂ ਹਾਂਜੀ ਪੇਮੈਂਟ ਦਾ ਤੁਸੀਂ ਕਿਹੜੇ ਮੋਡ ਰਾਹੀਂ ਕਰੋਗੇ ਔਨਲਾਈਨ ਕਿ ਕੈਸ਼ ਲਵੋਗੇ ਠੀਕ ਹੈ ਜੀ ਸਾਰਾ ਸਮਾਨ ਵਧੀਆ ਹੋਣਾ ਚਾਹੀਦਾ ਜੀ ਨਹੀਂ ਉਹ ਸਾਰਾ ਸਮਾਨ ਸਾਡੇ ਕੋਲ ਹੈਗਾ ਜੀ ਹਾਂਜੀ ਠੀਕ ਹੈ ਧੰਨਵਾਦ ਜੀ ਜੀ ਧੰਨਵਾਦ